ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੁਕਤਸਰ ਵਿੱਚ ਜੀ ਬਹੁਤ ਤਰਾਂ ਦੀ ਤਬਦੀਲੀਆਂ ਆ ਰਹੀਆਂ ਜੀ ਜਿਵੇਂ ਪਹਿਲਾਂ ਮੁਕਤਸਰ ਬਹੁਤ ਸੋਹਣਾ ਹੁੰਦਾ ਸੀ ਪਰ ਹੁਣ ਵਾਤਾਵਰਨ ਕਰਕੇ ਪਰ ਦੂਸ਼ਿਤ ਹੋ ਗਏ ਥੋੜਾ ਜਿਹਾ ਤੇ ਇਥੇ ਬਹੁਤ ਤਰਾਂ ਦੀ ਮਲਕੀ ਪ੍ਰੋਬਲਮ ਆ ਰਹੀ ਹ ਜਿਵੇਂ ਪਹਿਲਾ ਮੁਕਤਸਰ ਦਾ ਨਾਂ ਜਿਵੇਂ ਕੀ ਖਿਦਰਾਣਾ ਸੀ ਤੇ ਹੁਣ ਚਾਲੀ ਮੁਕਤਿਆਂ ਦੀ ਸ਼ਹੀਦੀ ਤੋਂ ਬਾਅਦ ਮਤਲਬ ਕਿ ਇਹਦਾ ਨਾਮ ਮੁਕਤਸਰ ਪੈ ਗਿਆ ਸੀ ਵੀ ਇਹਦੇ ਮੌਸਮ ਚ ਬਹੁਤ ਤਰਾਂ ਦੀ ਤਬਦੀਲੀਆਂ ਆ ਰਹੀਆਂ ਹਨ ਵੀ ਮੁਕਤਸਰ ਪਹਿਲਾਂ ਬਹੁਤ ਸੋਹਣਾ ਹੁੰਦਾ ਸੀ ਹੁਣ ਨੌਜਵਾਨਾਂ ਨੇ ਇਸਨੂੰ ਬਹੁਤ ਖਰਾਬ ਕਰ ਦਿੱਤਾ ਇਥੇ ਪਹਿਲਾਂ ਬਹੁਤ ਰੌਣਕ ਹੁੰਦੀ ਸੀ ਪਰੰਤੂ ਹੁਣ ਸਿਰਫ ਲੋਕ ਮਾਘੀ ਦੇ ਮੇਲੇ ਤੇ ਆਉਂਦੇ ਹਨ ਅਤੇ ਬਹੁਤ ਭਾਰੀ ਲੱਗਦਾ ਜੀ ਇਥੇ ਪਹਿਲਾਂ ਬਹੁਤ ਸਫਾਈ ਹੁੰਦੀ ਸੀ ਹੁਣ ਬਹੁਤ ਘੱਟ ਪਾਈ ਰਹਿਣ ਲੱਗੀ ਹ ਜੀ ਪਾਣੀ ਦਾ ਜਿਵੇਂ ਕੀ ਪ੍ਰਬੰਧਨ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਹੁਣ ਬਹੁਤ ਗੰਦਾ ਪਾਣੀ ਆਉਂਦਾ ਇਸ ਕਰਕੇ ਮੌਸਮ ਚ ਬਹੁਤ ਤਬਦੀਲੀ ਆ ਰਹੀ ਤੇ ਜੀ ਲੋਕਾਂ ਨੂੰ ਵੀ ਬਹੁਤ ਸਮੱਸਿਆ ਆ ਰਹੀਆਂ ਜੀ ਤੇ ਜੀ ਮੁਕਤਸਰ ਆਪਣੇ ਜਿਲਾ ਵਾਧਾ ਜੀ ਹਾਂਜੀ ਹਾਂਜੀ ਜੀ ਹਾਂਜੀ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਮੁਕਤਸਰ ਚ ਰਹਿੰਦੀ ਨੂੰ ਵੀ ਮੈਂ ਵੇਖਿਆ ਕਿ ਨਸ਼ੇ ਕਰਕੇ ਹੀ ਮੁਕਤਸਰ ਬਹੁਤ ਜਿਆਦਾ ਖਰਾਬ ਹੋ ਰਿਹਾ ਇੱਥੋਂ ਦੇ ਪ੍ਰਦੂਸ਼ਣ ਹੋ ਰਹੀ ਤੇ ਵਾਤਾਵਰ ਬਹੁਤ ਜਿਆਦਾ ਖਰਾਬ ਹੋ ਰਹੇ ਤੇ ਨੌਜਵਾਨਾਂ ਅੱਜ ਕੱਲ ਦੀ ਨੌਜਵਾਨ ਪੀੜੀ ਇਸ ਨੂੰ ਬਹੁਤ ਖਰਾਬ ਕਰ ਰਹੀ ਐ ਜੀ ਤੇ ਪ੍ਰਦੂਸ਼ਣ ਬਹੁਤ ਜਿਆਦਾ ਹੋ ਰਿਹਾ ਜੀ ਦੁਰਘਟਨਾਵਾਂ ਹੋ ਰਹੀ ਹ ਪਹਿਲਾਂ ਇਥੇ ਬਹੁਤ ਰੌਣਕ ਹੁੰਦੀ ਸੀਗੀ ਪਰ ਹੁਣ ਇਨੀ ਜਿਆਦਾ ਨਹੀਂ ਐ ਕਿਉਂਕਿ ਲੋਕ ਆਪਦੇ ਕੰਮਾਂ ਚ ਬਹੁਤ ਜਿਆਦਾ ਬਿਜ਼ੀ ਰਹਿਣ ਲੱਗੇ ਨੇ ਕਿਉਂਕਿ ਨਵੀਂ ਪੀੜੀ ਅਲੱਗ ਤਰ੍ਹਾਂ ਦੀ ਹੁੰਦੀ ਐ ਜੀ ਤਾਂ ਕਰਕੇ ਮੁਕਤਸਰ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਜੀ ਲੋਕਾਂ ਨੇ ਜੀ ਬਸ ਪ੍ਰਦੂਸ਼ਿਤ ਕਰਤਾ ਜੀ ਹਾਂਜੀ ਕੁਝ ਹੋਰ ਪੁੱਛਣਾ ਹੋਵੇ ਹਾਂਜੀ ਜੀ ਤੁਸੀਂ ਆਪ ਹੀ ਖੁਦ ਦੇਖ ਸਕਦੇ ਹੋ ਅੱਜ ਕੱਲ ਪੰਜਾਬ ਵਿੱਚ ਕੀ ਕੁਛ ਤਬਦੀਲੀਆਂ ਆ ਰਹੀਆਂ ਜੀ ਤੇ ਮੁਕਤਸਰ ਚ ਆਉਣੀ ਹੀ ਆਉਣੀ ਸੀਗੀ ਵੈਲਕਮ ਜੀ ਵੈਲਕਮ